ਬਾਰਾਂ ਜੂਨ ਉੱਨੀ ਸੌ ਚੁਰਾਨਵੇਂ ਪੱਚੀ ਅਗਸਤ ਉੱਨੀ ਸੌ ਨੱਬੇ ਦੋ ਜੂਨ ਉੱਨੀ ਸੌ ਅਠਾਸੀ ਛੱਬੀ ਜਨਵਰੀ ਉੱਨੀ ਸੌ ਉਣਾਹਠ ਅਠਾਈ ਫਰਵਰੀ ਦੋ ਹਜ਼ਾਰ ਚੌਵੀ